ਮੈਂ ਪੰਜਾਬ ਦੇ ਯਾਤਰੀ ਨੂੰ ਇਹ ਸੁਝਾਅ ਦੇਣਾ ਚਾਹੁੰਗਾ ਜੇਕਰ ਉਹ ਪੰਜਾਬ ਦੇ ਵਿੱਚ ਕਿਤੇ ਵੀ ਯਾਤਰਾ ਕਰਦੇ ਹੈ ਤਾਂ ਉਹ ਖ਼ਾਸ ਕਰਕੇ ਆਪਣੀ ਚੀਜ਼ਾਂ ਦਾ ਬਹੁਤ ਧਿਆਨ ਰੱਖਣ ਜਿਵੇਂ ਕਿ ਪੈਸੇ ਹੋ ਗਏ ਪਰਸ ਹੋ ਗਿਆ ਆਪਣੇ ਕੋਈ ਵੀ ਜਵੈਲਰੀ ਜੇਕਰ ਉਹ ਪਾ ਕੇ ਤੁਰਦੇ ਨੇ ਘਰੋਂ ਉਹਨਾਂ ਦਾ ਖ਼ਾਸ ਕਰਕੇ ਧਿਆਨ ਰੱਖਣ ਕਿਉਂਕਿ ਅੱਜ ਕੱਲ੍ਹ ਲੁੱਟਮਾਰ ਬਹੁਤ ਕੁ ਵੱਧ ਗਈ ਹੈ ਪੰਜਾਬ ਦੇ ਵਿੱਚ ਜੇਕਰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਜਾਦੇ ਹਾਂ ਤਾਂ ਉੱਥੇ ਵਿੱਚ ਰਸਤੇ 'ਚ ਕੀ ਕੁਛ ਵਾਪਰ ਜਾਏ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਅਤੇ ਨਾਲੇ ਜਿਹੜਾ ਵੀ ਜ਼ਿਲ੍ਹਾ ਲੈ ਲਓ ਜੇਕਰ ਤੁਸੀਂ ਲੁਧਿਆਣਾ ਬਰਨਾਲਾ ਬਠਿੰਡਾ ਅੰਮ੍ਰਿਤਸਰ ਜਿੱਥੇ ਵੀ ਤੁਸੀਂ ਜਾਂਦੇ ਹੋ ਤ ਤ ਤੁਹਾਨੂੰ ਇਹ ਹੀ ਦੇਖਣ ਨੂੰ ਮਿਲਦਾ ਹੈ ਕਿ ਵਿੱਚ ਰਸਤੇ 'ਚ ਕਿਸੇ ਬੰਦੇ ਨਾਲ ਲੁੱਟਮਾਰ ਹੋ ਗਈ ਅਤੇ ਇਸ ਚੀਜ਼ ਨੂੰ ਰੋਕਣ ਲਈ ਨਾ ਲੋਕਾਂ ਨੂੰ ਸਤਰਕਤਾ ਵਰਤਣੀ ਪਏਗੀ ਕਿ ਆਪਣੇ ਜਿਵੇਂ ਵੀ ਕੋਈ ਵੀ ਚੀਜ਼ ਹੁੰਦੀ ਹੈ ਪਰਸ ਹੋ ਗਿਆ ਆਪਣਾ ਕੋਈ ਵੀ ਗਹਿਣਾ ਹੋ ਗਿਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਚੱਲਣ ਅਤੇ ਨਾਲੇ ਇੱਕ ਇੱਕ ਵਾਰ ਆਪਣੀ ਲੋਕੇਸ਼ਨ ਵੀ ਆਪਣੇ ਘਰਦਿਆਂ ਨੂੰ ਦੇ ਕੇ ਚੱਲਣ ਜੇਕਰ ਉਹ ਕਿਤੇ ਕਿਸੇ ਘਟਨਾ ਦੇ ਨਾਲ ਵਾਪਰ ਦੀ ਆ ਉਹਨਾਂ ਦੇ ਨਾਲ ਫਿਰ ਕੱਲ੍ਹ ਨੂੰ ਉਹਦੇ ਲਈ ਘਰ ਦੇ ਉਹਨਾਂ ਦਾ ਪਤਾ ਲੈ ਸਕਣ ਕਿ ਸਾਡੇ ਬੱਚੇ ਜਾਂ ਸਾਡਾ ਕੋਈ ਘਰ ਦਾ ਗਿਆ ਕਿੱਥੇ ਸੀਗਾ ਜਿਹਦੇ ਨਾਲ ਉਹ ਜਿੱਥੇ ਵੀ ਘਟਨਾ ਵਾਪਰ ਗਈ ਤਾਂ ਪੁਲਿਸ ਉਹਦੇ ਦੀ ਹੈਲਪ ਕਰੇਗੀ